ਵਿਗਿਆਨ ਅਤੇ ਟੈਕਨੋਲਜੀ ਨੇ ਮਹਾਂਮਾਰੀ ਦੌਰਾਨ ਲੋਕਾਂ ਨੂੰ ਅਧਿਐਨ ਵਿੱਚ ਬਹੁਤ ਮਦਦ ਕੀਤੀ ਹੁਣ ਹੀ ਜਿਵੇਂ ਤਿੰਨ ਚਾਰ ਸਾਲ ਪਹਿਲਾਂ ਮਹਾਂਮਾਰੀ ਕਰੋਨਾ ਕਾਲ ਦੌਰਾਨ ਸਾਰਿਆਂ ਦਾ ਘਰੋਂ ਨਿਕਲਣਾ ਬੰਦ ਕਰ ਦਿੱਤਾ ਗਿਆ ਸੀ ਬੱਚੇ ਸਕੂਲ ਨਹੀਂ ਸੀ ਜਾ ਸਕਦੇ ਅਨ ਉਹਨਾਂ ਦੀ ਪੜ੍ਹਾਈ ਬਰਬਾਦ ਹੋ ਜਾਣੀ ਸੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਜੂਮ ਐਪ ਜੂਮ ਐਪ ਦੇ ਰਾਹੀਂ ਬੱਚਿਆਂ ਨੂੰ ਟੀਚਰਾਂ ਨੇ ਘਰਾਂ ਵਿੱਚ ਬੈਠ ਕੇ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਬੱਚਿਆਂ ਨੇ ਘਰਾਂ ਵਿੱਚ ਬੈਠ ਕੇ ਪੜ੍ਹਨਾ ਸ਼ੁਰੂ ਕੀਤਾ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਨਹੀਂ ਹੋਇਆ ਬੱਚਿਆਂ ਦਾ ਪੜ੍ਹਾਈ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਦੋ ਜਿਵੇਂ ਯੂਟਿਊਬ ਦੇ ਵਿੱਚ ਅਸੀਂ ਸਰਚ ਕਰਕੇ ਕੁਛ ਵੀ ਲੱਭ ਸਕਦੇ ਹਾਂ ਕੁਛ ਵੀ ਅਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜਿਵੇਂ ਕੋਈ ਰੈਸਿਪੀ ਬਣਾਉਣ ਵਾਸਤੇ ਜਿਵੇਂ ਕੋਈ ਰੈਸਿਪੀ ਬਣਾਉਣ ਵਾਸਤੇ ਅਸੀਂ ਸਰਚ ਕਰਕੇ ਯੂਟਿਊਬ ਦੇ ਵਿੱਚ ਵੇਖ ਵੇਖ ਕੇ ਕੋਈ ਰੈਸਿਪੀ ਵੀ ਬਣਾ ਸਕਦੇ ਹਾਂ ਅਤੇ ਜਿਵੇਂ ਕੋਈ ਸੂਟ ਤਿਆਰ ਕਰਨਾ ਹੋਵੇ ਉਹਦੀ ਕੋਈ ਕਟਾਈ ਵਢਾਈ ਕੋਈ ਵੇਖਣੀ ਹੋਵੇ ਤਾਂ ਅਸੀਂ ਇਸ ਟੈਕਨੋਲਜੀ ਰਾਹੀਂ ਵੇਖ ਕੇ ਆਪਣੇ ਸੂਟ ਕੁਛ ਵੀ ਤਿਆਰ ਕਰ ਸਕਦੇ ਹਾਂ ਕੁਛ ਕਿਸੇ ਵੀ ਚੀਜ਼ ਦਾ ਅਸੀਂ ਲਾਭ ਉਠਾ ਸਕਦੇ ਹਾਂ ਅਤੇ ਇਸ ਟੈਕਨੋਲਜੀ ਦੇ ਨੁਕਸਾਨ ਵੀ ਬਹੁਤ ਹਨ ਜਿਵੇਂ ਬੱਚੇ ਏ ਇਸ ਤੋਂ ਇਸ ਟੈਕਨੋਲਜੀ ਯੂਟਿਊਬ ਤੋਂ ਵੇਖ ਵੇਖ ਕੇ ਮਾੜੀਆਂ ਚੀਜ਼ਾਂ ਨੂੰ ਆਪਣੇ ਦਿਮਾਗ ਵਿੱਚ ਬਿਠਾ ਰਹੇ ਹਨ ਅਤੇ ਬੱਚਿਆਂ 'ਤੇ ਮਾੜਾ ਨੁਕਸਾਨ ਪੈ ਰਿਹਾ ਹੈ